ਹੈਲੋ ਹਾਂਜੀ ਹਾਂਜੀ ਹੋਰ ਵੀਰ ਜੀ ਕੀ ਹਾਲ ਚਾਲ ਆ ਵਧੀਆ ਸਾਡੇ ਤਰਨ ਤਾਰਨ ਸ਼ਹਿਰ ਦੇ ਅਤੇ ਜਿੰਨਾ ਵੀ ਸਾਡਾ ਇਲਾਕਾ ਤਰਨਤਾਰਨ ਸਾਰੇ ਹੀ ਮੁੰਡੇ ਬਾਹਰ ਜਾ ਰਹੇ ਨੇ

ਹਾਂਜੀ ਠੀਕ ਹੈ ਜੀ

ਹਾਂਜੀ ਹਾਂਜੀ

ਹੁਣ ਜਦੋਂ ਦਾ ਜ਼ਿਲ੍ਹਾ ਬਣਿਆ ਵੀਹ ਸਾਲ ਹੋ ਗਏ ਆਪਣੇ ਜ਼ਿਲ੍ਹੇ ਨੂੰ ਬਣੇ ਇੱਥੋਂ ਹਜੇ ਤੱਕ ਕਿ ਵੀਰ ਜੀ ਜਿਵੇਂ ਰੇਲਵੇ ਸਟੇਸ਼ਨ ਹੈ ਉੱਥੇ ਹਜੇ ਤੱਕ ਪੂਰੇ ਪ੍ਰੋਪਰ ਨਹੀਂ ਹੋਇਆ ਹਜੇ ਤੱਕ ਵੀ ਆਹੋ ਇਸ ਲਈ ਹਾਂਜੀ

ਉਹ ਦੱਸਾਂ ਵੀਰ ਜੀ ਮੈਂ ਤੁਹਾਨੂੰ ਦੱਸਦਾ ਗੱਲ ਦੱਸਾਂ ਕਿਉਂ ਹਰ ਕੋਈ ਮਾਂ ਪਿਓ ਸੋਚਦਾ ਵੀ ਅਸੀਂ ਆਪਣਾ ਨਾ ਬੱਚਾ ਇੰਨਾ ਚਿਰ ਪੜ੍ਹਾਇਆ ਵਾ ਠੀਕ ਹੈ ਕਿਸੇ ਨੇ ਪਲੱਸ ਟੂ ਕਰੀ ਹੈ ਕਿਸੇ ਨੇ ਬੀ ਐਡ ਕਰੀ ਹੈ ਕਿਹ ਕਿਸੇ ਨੇ ਮੈਟ੍ਰਿਕਸ ਕੀਤੀ ਆ ਉਹਨਾਂ ਦਾ ਬੱਚਾ ਕੋਈ ਇਹੋ ਜਿਹੇ ਕੰਮ ਨਸ਼ੇ ਵਿਚ ਨਾ ਲੱਗ ਜਾਵੇ ਠੀਕ ਹੈ ਜੀ ਇਸ ਕਰਕੇ ਉਹ ਸੋਚਦੇ ਹਾਂ ਵੀ ਚਲੋ ਜੇ ਅਸੀਂ ਆਪਣੇ ਬੱਚੇ ਨੂੰ ਬਾਹਰ ਦੀ ਕੰਟਰੀ ਜਾਂ ਦੁਬਈ ਜਾਂ ਕੈਨੇਡਾ ਯੂ ਕੇ ਕਿਤੇ ਵੀ ਅਸੀਂ ਭੇਜ ਦੇਈਏ ਵੀ ਸਾਡਾ ਬੱਚਾ ਸੇਫ ਹੋ ਜਾਵੇ ਅਤੇ ਉਹ ਪੰਜਾ ਹੁਣ ਤਰਨ ਤਾਰਨ ਜ਼ਿਲ੍ਹੇ ਵਿੱਚ ਨਸ਼ੇ ਦਾ ਇੰਨਾ ਦੌਰ ਆ ਵੀ ਆਪਾਂ ਕਹਿ ਨਹੀਂ ਸਕਦੇ ਇਹ ਹਰ ਇੱਕ ਬ ਆਦਮੀ ਨੂੰ ਪਤਾ ਵਾ ਹਾਂਜੀ ਇਸ ਕਰਕੇ ਉਹ ਸੋਚਦੇ ਵੀ ਸਾਡੇ ਬੱਚੇ ਬਾਹਰ ਚਲ ਜਾਣ ਅਤੇ ਸਾਡਾ ਬੱਚਾ ਸੇਫ ਰਹੇ ਹਾਂਜੀ

ਹੋਰ ਵੀਰ ਜੀ ਦੱਸਾਂ ਕੀ ਗੱਲ ਆ ਸਰਕਾਰ ਸਿਰਫ ਆਪਣਾ ਹੀ ਇੱਕ ਆਪਣੇ ਢਿੱਡ ਭਰਦੀ ਆ ਜਿਵੇਂ ਆਪਣੇ ਇਲਾਕੇ ਵਿੱਚ ਕੋਈ ਨਹੀਂ ਖੋਲ੍ਹੀ ਜਾਂਦੀ ਕੋਈ ਇਹੋ ਜਿਹੀਆਂ 'ਚ ਮੋਲ ਖੋਲ੍ਹੇ ਜਾਂਦੇ ਆ ਵੱਡੇ ਵੱਡੇ ਮੋਲ ਖੋਲ੍ਹ ਤੇ ਹਾਂ ਇੱਥੇ ਕੱਪੜੇ ਦੀ ਫੈਕਟਰੀ ਲੱਗਦੀ ਜੋ ਕਿ ਜਿਹੜਾ ਮੁੰਡੇ ਜਿੰਨੇ ਬਾਹਰ ਜਾਣਾ ਚਾਹੁੰਦੇ ਉਹ ਸਾਰੇ ਆਪੋ ਆਪਣਾ ਸੇਫ ਹੋ ਕੇ ਅਤੇ ਕੰਮ ਕਰਦੇ ਅਤੇ ਬਾਹਰ ਜਾਣ ਦੀ ਲੋੜ ਨਾ ਪੈਂਦੀ

ਪਰ ਸਾਡੇ ਤਰਨ ਤਾਰਨ ਦੇ ਵਿੱਚ ਕੁਝ ਕੁ ਨਸ਼ਾ ਤੁਹਾਨੂੰ ਪਤਾ ਜ਼ਿਆਦਾ ਹੀ ਆ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਇਸ ਲਈ ਕੋਈ ਛੋਟਾ ਛੋਟਾ ਬੱਚੇ ਨੂੰ ਵੀ ਆਹੀ ਸੋਚਦੇ ਆ ਕਿ ਅਸੀਂ ਆਪਣੇ ਬੱਚੇ ਨੂੰ ਥੋੜ੍ਹੀ ਬਹੁਤੀ ਪੜ੍ਹਾਈ ਕਰੀਏ ਅਤੇ ਇਹ ਨੂੰ ਬਾਹਰ ਭੇਜ ਦੇਈਏ ਇਹ ਹਾਂ ਇਸ ਲਈਏ ਅੱਜ ਕੱਲ੍ਹ ਲੋਕ ਆਪਣੇ ਬੱਚਿਆਂ ਨੂੰ ਸੇਫ ਰੱਖਣ ਵਾਸਤੇ ਬਾਹਰ ਭੇਜ ਦਿੰਦੇ ਆ ਹਾਂਜੀ ਹੋਰ ਬਾਕੀ ਵੀਰ ਜੀ ਠੀਕ ਠਾਕ ਸਭ ਕੁਝ ਪਰ ਬੜੀ ਚਲੋ ਵਧੀਆ ਜੀ ਹੋਰ ਬਾਕੀ ਠੀਕ ਠਾਕ ਸਭ ਜੀ ਚਲੋ ਠੀਕ ਹੈ ਵੀਰ ਜੀ ਓਕੇ ਬਾਏ